ਸਤਿ ਸ਼੍ਰੀ ਅਕਾਲ ਜੀ ਸਰਕਾਰ ਰਾਜ ਵਿੱਚ ਛੋਟੇ ਕਾਰੋਬਾਰਾਂ ਦੀ ਕਿਵੇਂ ਮਦਦ ਕਰਦੀ ਹੈ ਆਹ ਤਾਂ ਜੀ ਜਿਹੜੀ ਸਕੀਮ ਸਕੀਮਾਂ ਸਰਕਾਰ ਲੈ ਕੇ ਆਉਂਦੀ ਹੈ ਛੋਟੇ ਕਾਰੋਬਾਰਾਂ ਦੇ ਲਈ ਜਿਵੇਂ ਜਿਵੇਂ ਕਈ ਸਕੀਮਾਂ ਪਿੱਛੇ ਚੱਲੀ ਹੈ ਜਿਵੇਂ ਪੰਜਾਬ ਚੀਫ ਮਨਿਸਟਰ ਯੂਥ ਸੈਲਫ ਇੰਪਲੋਮੈਂਟ ਸਕੀਮ ਹੋ ਗਈ ਇੰਡਸਟਰੀਅਲ ਮੋਟੀਵੇਸ਼ਨ ਕਪੇਨਸ ਹੈ ਇਹ ਜਿਹੜੀਆਂ ਚੀਜ਼ਾਂ ਇਹ ਮੁੱਖ ਮੁੱਖ ਰੂਪ ਤੋਂ ਜੀ ਇਹ ਹੈਗੀ ਵੀ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਜਿਹੜੇ ਬੰਦੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈ ਉਹਨਾਂ ਨੂੰ ਸਕਿਲ ਉਹਨਾਂ ਦਾ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਟ੍ਰੇਨਰ ਬਿਠਾ ਕੇ ਉਹਨਾਂ ਨੂੰ ਕੰਮ ਸਿਖਾਇਆ ਜਾਂਦਾ ਤਾਂ ਕਿ ਉਹ ਪਿੰਡਾਂ ਦੇ ਵਿੱਚ ਰਹਿੰਦੇ ਹੋਵੇ ਭਾਵੇਂ ਮੰਡੀਆਂ 'ਚ ਰਹਿੰਦੇ ਛੋਟੀ ਮੰਡੀਆਂ 'ਚ ਉੱਥੇ ਜਾ ਕੇ ਉਹ ਅਪ ਆਪਦਾ ਸਕਿਲ ਕੰਮ ਸਿੱਖ ਕੇ ਪਹਿਲਾਂ ਟ੍ਰੇਨਰ ਤੋਂ ਸਰਕਾਰੀ ਟ੍ਰੇਨਰ ਤੋਂ ਜਿਹੜਾ ਗੌਰਮੈਂਟ ਦਾ ਇੰਪਲੋ ਅਪ ਇੱਥੇ ਅਪੋਇੰਟ ਕੀਤਾ ਹੋਇਆ ਉਹਦੇ ਤੋਂ ਕੰਮ ਸਿੱਖ ਕੇ ਟ੍ਰੇਨਿੰਗ ਲੈ ਕੇ ਫਰੀ ਦੇ ਵਿੱਚ ਸਰਕਾਰ ਨੇ ਇਹ ਸਕੀਮਾਂ ਕਹੀ ਜਾਂ ਘੱਟ ਪੈਸਿਆਂ ਦੇ ਵਿੱਚ ਫੀਸ ਦੇ ਵਿੱਚ ਇਹ ਚਲਾ ਰੱਖੀਆਂ ਨੇ ਅਤੇ ਤਾਂ ਉਹਨਾਂ ਤੋਂ ਬੰਦੇ ਲੋਕ ਜਿਹੜੇ ਹੈਗੇ ਘੱਟ ਪੜ੍ਹੇ ਲਿਖੇ ਉਹ ਵੀ ਆਪਦਾ ਸਕਿਲ ਇੰਪਰੂਵ ਕਰਕੇ ਕੰਮ ਸਿੱਖ ਕੇ ਅਤੇ ਫੀਲਡ ਦੇ ਵਿੱਚ ਆਪਣਾ ਕੰਮ ਕਰਕੇ ਦੋ ਪੈਸੇ ਵਧੀਆ ਗ ਪੈਸੇ ਕਮਾ ਸਕਦੇ ਹਨ ਅਤੇ ਆਪਦੇ ਪਰਿਵਾਰ ਦਾ ਗੁਜ਼ਾਰਾ ਕਰ ਸਕਦੇ ਹਨ